ਤਰਨ ਤਾਰਨ ਜ਼ਿਲ੍ਹੇ ਦੇ ਮੌਸਮ ਦੀ ਗੱਲ ਕਰੀਏ ਤਾਂ ਇੱਥੇ ਸਰਦੀ ਵੀ ਹੁੰਦੀ ਆ ਗਰਮੀ ਵੀ ਹੁੰਦੀ ਆ ਪਤਝੜ ਵੀ ਹੁੰਦੀ ਆ ਅਤੇ ਬਾਰਿਸ਼ ਹੁੰਦੀ ਆ ਮੈਂ ਇੱਥੋਂ ਦੇ ਹਰ ਮੌਸਮ ਦਾ ਚੰਗੀ ਤਰ੍ਹਾਂ ਅਨੁਭਵ ਕੀਤਾ ਹੋਇਆ ਜਿਵੇਂ ਕਿ ਗਰਮੀ ਗਰਮੀ ਦੇ ਦਿਨਾਂ ਵਿੱਚ ਇੱਥੇ ਇੰਨੀ ਕੁ ਜ਼ਿਆਦਾ ਗਰਮੀ ਪੈਂਦੀ ਆ ਕਿ ਘਰੋਂ ਬਾਹਰ ਨਿਕਲਣਾ ਬੜਾ ਹੀ ਔਖਾ ਹੋ ਜਾਂਦਾ ਵਾ ਲੂ ਇੰਨੀ ਜ਼ਿਆਦਾ ਵਗਦੀ ਆ ਕਿ ਸਾਰਾ ਸਰੀਰ ਜਿਹੜਾ ਵਾ ਉਹ ਨਿਕਲਣ ਨੂੰ ਹੀ ਘਰੋਂ ਬਾਹਰ ਦਿਲ ਨਹੀਂ ਕਰਦਾ ਜੇ ਆਪਾਂ ਕਿਤੇ ਬਾਜ਼ਾਰ ਜਾਂ ਕਿਤੇ ਜਾਣਾ ਵਾ ਅਤੇ ਸਾਨੂੰ ਦਸ ਆਪਣੇ ਸਰੀਰ ਨੂੰ ਕਵਰ ਕਰਕੇ ਦਸਤਾਨੇ ਵਗੈਰਾ ਪਾ ਕੇ ਫਿਰ ਆਪਣੀ ਬਾਈਕ 'ਤੇ ਜਾਣਾ ਪੈਂਦਾ ਤਾਂ ਜੋ ਘੱਟਾ ਮਿੱਟੀ ਇੰਨਾ ਹੁੰਦਾ ਵਾ ਉਹਦੇ ਨਾਲ ਕੀ ਆ ਸਕਿੰਨ ਜਿਹੜੀ ਆ ਉਹ ਖਰਾਬ ਹੋ ਜਾਂਦੀ ਆ ਜੇਕਰ ਸਿਆਲ ਸਰਦੀਆਂ ਦੀ ਗੱਲ ਕੀਤੀ ਜਾਵੇ ਤਾਂ ਸਰਦੀ ਦੇ ਮੌਸਮ ਵਿੱਚ ਜਿਹੜੀ ਆ ਉਹ ਧੂੰਦ ਆ ਬਹੁਤ ਜ਼ਿਆਦਾ ਪੈਂਦੀ ਆ ਧੂੰਦ ਇੰਨੀ ਸੰਘਣੀ ਹੁੰਦੀ ਆ ਕਿ ਆਪਾਂ ਸਾਹਮਣੇ ਵਾਲੇ ਕੋਈ ਵੀ ਚੀਜ਼ ਆ ਉਹ ਸਾਨੂੰ ਨਜ਼ਰ ਨਹੀਂ ਆਉਂਦੀ ਜੇ ਆਪਾਂ ਆਪਣੀ ਮੋਟਰ ਗੱਡੀ 'ਤੇ ਜਾਣਾ ਵਾ ਅਤੇ ਸਾਨੂੰ ਬੜੇ ਧਿਆਨ ਦੇ ਨਾਲ ਗੱਡੀ ਦੀਆਂ ਬੱਤੀਆਂ ਜਗਾ ਕੇ ਫਿਰ ਜਾਣਾ ਪੈਂਦਾ ਵਾ ਪਤਝੜ ਦੇ ਵਿੱਚ ਜਿਹੜੇ ਆ ਇਹਦੇ ਸਾਰੇ ਪੱਤੇ ਜਿਹੜੇ ਆ ਰੁੱਖ ਆਪਣੇ ਡੇਗ ਦਿੰਦੇ ਆ ਅਤੇ ਜਦੋਂ ਬਾਰਿਸ਼ ਦਾ ਮੌਸਮ ਸ਼ੁਰੂ ਹੁੰਦਾ ਵਾ ਫਿਰ ਇੰਨੀਆਂ ਤੇਜ਼ ਹਵਾਵਾਂ ਚੱਲਦੀਆਂ ਵਾ ਇੰਨੀਆਂ ਤੇਜ਼ ਹਵਾਵਾਂ ਚੱਲਦੀਆਂ ਵਾ ਕਿ ਕਈ ਰੁੱਖਾਂ ਦਾ ਆਪਣੀਆਂ ਜੜ੍ਹਾਂ ਤੋਂ ਹੀ ਪੁੱਟੇ ਜਾਂਦੇ ਆ ਕਈ ਇਹਨਾਂ ਦਾ ਨੁਕਸਾਨ ਹੋ ਜਾਂਦਾ ਵਾ ਪਤਝੜ ਦੇ ਬਾਰਿਸ਼ ਦੇ ਦਿਨਾਂ ਵਿੱਚ ਬਾਕੀ ਹੜ੍ਹ ਦੀ ਸਮੱਸਿਆ ਜਿਹੜੀ ਆ ਉਹ ਮੈਂ ਇੱਥੇ ਇੰਨੀ ਨਹੀਂ ਵੇਖੀ ਕਿਉਂਕਿ ਇਸ ਜ਼ਿਲ੍ਹੇ ਵਿੱਚ ਸਾਡੇ ਜਿਹੜਾ ਵਾ ਕੋਈ ਦਰਿਆ ਨਹੀਂ ਪੈਂਦਾ ਦਰਿਆ ਤੁਹਾਨੂੰ ਪਤਾ ਹੀ ਆ ਦੇ ਹੜ੍ਹ ਉੱਥੇ ਹੀ ਆਉਂਦੇ ਆ ਜਿੱਥੋਂ ਪਾਣੀ ਦਾ ਪੱਧਰ ਜ਼ਿਆਦਾ ਵੱਧ ਜਾਂਦਾ ਵਾ ਅਤੇ ਹੜ੍ਹਾਂ ਦੀ ਜਿਹੜੀ ਆ ਮੈਂ ਉਹ ਚੀਜ਼ ਜਿਹੜੀ ਆ ਉਹ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਅਜੇ ਅਨੁਭਵ ਨਹੀਂ ਕੀਤੀ